ਪੰਜਾਬ ਵਿੱਚ ਸਿੱਖਿਆ ਪ੍ਰਣਾਲੀ ਸਕੂਲ ਛੱਡਣ ਅਤੇ ਗੈਰ ਹਾਜ਼ਰੀ ਦੇ ਮੁੱਦੇ ਵਿੱਚ ਬਹੁਤ ਸਾਰੇ ਹੱਲ ਕੀਤੇ ਗਏ ਹਨ ਜਿਵੇਂ ਕਿ ਬੱਚਿਆਂ ਨੂੰ ਘਰ ਬੈਠ ਕੇ ਹੀ ਪੜ੍ਹਾਈ ਦਿੱਤੀ ਪੜ੍ਹਾਈ ਜਾਂਦੀ ਹੈ ਔਨਲਾਈਨ ਪੜ੍ਹਾਈ ਕਰਵਾਈ ਜਾਂਦੀ ਹੈ ਜਿੱਦਾਂ ਕਿ ਬੱਚਿਆਂ ਕੋਲ ਸਮਾਰਟਫੋਨ ਹੋਣਾ ਜ਼ਰੂਰੀ ਹੈ ਅਤੇ ਮੈਂ ਮੈਡਮ ਕੋਲ ਵੀ ਸਮਾਰਟਫੋਨ ਹੋਣਾ ਜ਼ਰੂਰੀ ਹੈ ਘਰ ਬੈਠੇ ਹੀ ਉਹਨਾਂ ਨੂੰ ਜਿੱਦਾਂ ਧੁੰਦ ਦੇ ਕਾਰਨ ਘਰ ਬੈਠੇ ਹੀ ਔਨਲਾਈਨ ਪੰਜਵੀਂ ਜਮਾਤ ਤੋਂ ਘੱਟ ਬੱਚਿਆਂ ਨੂੰ ਔਨਲਾਈਨ ਕਲਾਸਾਂ ਲਗਾ ਦਿੱਤੀਆਂ ਲਗਾ ਰਹੇ ਹਨ ਤਾਂ ਕਿ ਜੋ ਬੱਚੇ ਘਰ ਬੈਠ ਕੇ ਹੀ ਸੋਹਣੇ ਵਾਤਾਵਰਨ ਵਿੱਚ ਪੜ੍ਹਾਈ ਕਰ ਸਕਣ ਉਹਨਾਂ ਨੂੰ ਧੁੰਦ ਵਿੱਚ ਸਕੂਲ ਆਉਣ ਵਿੱਚ ਕੋਈ ਵੀ ਮੁਸ਼ਕਲ ਨਾ ਹੋਵੇ ਅੱਜ ਔ ਔਨਲਾਈਨ ਜਿਵੇਂ ਜਿਵੇਂ ਕਿ ਦੋ ਹਜ਼ਾਰ ਵੀਹ ਵਿੱਚ ਕਰੋਨਾ ਆਇਆ ਸੀ ਉਸ ਟਾਈਮ ਔਨਲਾਈਨ ਨੇ ਬਹੁਤ ਜ਼ਿਆਦਾ ਸਮਾਰਟਫੋਨ ਨੇ ਸਹੂਲਤਾਂ ਦਿੱਤੀਆਂ ਸੀ ਜਿਵੇਂ ਕਿ ਘਰ ਬੈਠੇ ਸਾਰਿਆਂ ਦਾ ਕਾਰੋਬਾਰ ਚੱਲ ਰਿਹਾ ਪੜ੍ਹਾਈ ਚੱਲੀ ਕੋਈ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਿਆ